ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਸਾਜਨ ਭਾਅ ਜੀ ਹੋਰ ਸੁਣਾਓ ਕੀ ਹਾਲ ਜੇ ਹੋਰ ਹੋ ਗਿਆ ਬੇਟਾ ਪਾਸ ਹਾਂਜੀ ਬੇਟਾ ਪਾਸ ਹੋ ਗਿਆ ਹਾਂਜੀ ਚਲੋ ਮੈਂ ਨਾ ਆਪਣੇ ਬੇਟੇ ਦੀ ਐਡਮਿਸ਼ਨ ਕਰਵਾਓਣੀ ਸੀ ਤਾਂ ਮੈਂ ਹਾਂ ਭਾਅ ਜੀ ਨਾਲ਼ ਡਿਸਕਸ ਕਰਾਂ ਆਪਣੇ ਤਰਨਤਾਰਨ ਵਿੱਚ ਕਿਹੜਾ ਬੈਸਟ ਸਕੂਲ ਹੈ ਚਲੋ ਕੋਈ ਗੱਲ ਨਹੀਂ ਪਲੱਸ ਵਨ 'ਚ ਹੁਣ ਐਡਮਿਸ਼ਨ ਤਾਂ ਦਿਵਾਉਣੀ ਨਿਆਣੇ ਤਾਂ ਇੱਦਾਂ ਹੀ ਕਰਦੇ ਆ ਕੋਈ ਨਾ ਅਤੇ ਹੁਣ ਐਡਮਿਸ਼ਨ ਦਿਵਾਉਣੀ ਆ ਆਪਾਂ ਨੇ ਕਿਹੜੇ ਸਕੂਲ ਕਿਹੜਾ ਸਕੂਲ ਏ ਬੈਸਟ ਹਾਂ ਹਾਂ ਮੈਂ ਤਾਂ ਹਾਂ ਅੱਛਾ ਅੱਛਾ ਹਾਂ ਹਾਂ ਵੈਸੇ ਉਹ ਵਾਲਾ ਬੈਟਰ ਏ ਨਾ ਉਹ ਵਾਲਾ ਮਹਾਰਾਜੇ ਮਹਾਂ ਐਡਮਿਸ਼ਨ ਦਵਾ ਦਿੰਦੇ ਹਾਂ ਹੈ ਨਾ ਤੁਹਾਡਾ ਵੀ ਬੇਟਾ ਉੱਥੇ ਪੈ ਜਾਏਗਾ ਤਾਂ ਚਲੋ ਇਕੱਠੇ ਦੋਸਤ ਇੱਕੋ ਜਗ੍ਹਾ 'ਤੇ ਹੋ ਜਾਣਗੇ ਹਾਂ ਇੱਕ ਵਾਰੀ ਜਾ ਕੇ ਨਾ ਉੱਥੇ ਫਿਰ ਤਾਂ ਆਪਾਂ ਕੋਈ ਟਾਈਮ ਰੱਖਦੇ ਹਾਂ ਉੱਥੇ ਜਾ ਕੇ ਸਾਰਾ ਪਤਾ ਕਰਕੇ ਆਉਂਦੇ ਹਾਂ ਵੀ ਕੀ ਹਿਸਾਬ ਕਿਤਾਬ ਏ ਹੈ ਨਾ ਐਡਮਿਸ਼ਨ ਫੀਸ ਵਗੈਰਾ ਦਾ ਹਮ ਹਾਂ ਠੀਕ ਹੈ ਵੀਰ ਜੀ ਚਲੋ ਫਿਰ ਮੈਂ ਕਰਦੀ ਤੁਹਾਨੂੰ ਫਿਰ ਕਾਲ ਠੀਕ ਹੈ ਹਾਂ ਚਲੋ ਥੈਂਕ ਯੂ ਓਕੇ ਬਾਏ